ਭਾਰਤ ਵਿੱਚ ਮੇਰਾ ਮਨਪਸੰਦ ਰਾਜ ਜਿਹੜਾ ਹੈ ਉਹ ਹੈ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਇਸ ਕਰਕੇ ਹੈ ਕਿਉਂਕਿ ਇਹ ਇਹ ਰਾਜੇਯ ਵਿੱਚ ਬੜੀ ਧਾਰਮਿਕ ਜਗਾਵਾਂ ਹਨ ਜੈਸੇ ਕਿ ਵਰਿੰਦਾਵਨ ਮਥੁਰਾ ਅਤੇ ਕਾਸ਼ੀ ਵਿਸ਼ਵਨਾਥ ਜਾਂ ਕਹਿ ਲਓ ਅਯੋਧਿਆ ਮੇਨ ਆ ਮੇਰਾ ਬਹੁਤ ਜ਼ਿਆਦਾ ਮਨ ਹੈ ਇਸ ਜਗ੍ਹਾਵਾਂ ਦਾ ਜੋ ਕਿ ਪਹਿਲੀ ਗੱਲ ਕੀਤੀ ਜਾਵੇ ਜਿਹੜੀ ਮਥੁਰਾ ਵਰਿੰਦਾਵਨ ਦੀ ਹੈ ਉੱਥੇ ਕ੍ਰਿਸ਼ਨ ਦੀ ਜਨਮ ਭੂਮੀ ਹੈਗੀ ਹੈ ਅਤੇ ਉੱਥੇ ਉਹਨਾਂ ਦੇ ਛੋਟੇ ਲੈ ਕੇ ਵੱਡੇ ਰਾਸ ਲੀਲਾ ਸਾਰੀਆਂ ਉਹਨਾਂ ਦੇ ਦਰਸ਼ਨ ਅਤੇ ਬਹੁਤ ਵਧੀਆ ਸਥਾਨ ਹੈਗਾ ਅਤੇ ਮੇਰਾ ਉੱਥੇ ਜਾਣ ਦਾ ਬਹੁਤ ਮਨ ਹੈਗਾ ਅਤੇ ਉਹਨਾਂ ਦੇ ਦਰਸ਼ਨ ਕਰਨ ਦਾ ਬਹੁਤ ਮਨ ਹੈ ਅਤੇ ਕਿਸ ਤਰ੍ਹਾਂ ਉੱਥੇ ਰਾਧੇ ਰਾਧੇ ਦੀ ਧੁੰਨ ਸਾਰਿਆਂ ਦੇ ਮੂੰਹ 'ਤੇ ਰਾਧੇ ਰਾਧੇ ਜੁੜਿਆ ਹੁੰਦਾ ਹੈ ਅਤੇ ਸਾਕਸ਼ਾਤ ਕ੍ਰਿਸ਼ਨ ਜੀ ਉੱਥੇ ਆਪ ਬੈਠੇ ਹੋਣ ਦੂਸਰੇ ਜੇ ਆਪਾਂ ਅਯੋਧਿਆ ਦੀ ਗੱਲ ਕਰੀਏ ਅਯੋਧਿਆ ਨਗਰੀ ਇਹਨੂੰ ਇੰਨਾਂ ਸੁੰਦਰ ਬਣਾ ਦਿੱਤਾ ਗਿਆ ਕਿ ਰਾਮ ਜੀ ਉਥੇ ਜਿਵੇਂ ਖ਼ੁਦ ਆ ਕੇ ਵੱਸ ਗਏ ਹੋਣ ਅਤੇ ਮੇਰਾ ਉੱਥੇ ਜਾਣ ਦਾ ਬਹੁਤ ਜ਼ਿਆਦਾ ਮਨ ਹੈਗਾ ਅਯੋਧਿਆ ਨਗਰੀ ਦਾ ਅਤੇ ਉੱਥੇ ਵੀ ਬਹੁਤ ਸੋਹਣਾ ਮੰਦਰ ਬਹੁਤ ਜ਼ਿਆਦਾ ਵਧੀਆ ਇਨਵਾਇਰਮੈਂਟ ਹੈਗਾ ਬਹੁਤ ਜ਼ਿਆਦਾ ਧਾਰਮਿਕ ਮੇਰੀ ਵੈਸੇ ਹੀ ਮੇਰੇ ਦਿਲੋਂ ਹੀ ਮੈਂ ਬਹੁਤ ਜ਼ਿਆਦਾ ਧਾਰਮਿਕ ਹਾਂ ਅਤੇ ਮੈਨੂੰ ਇਹਨਾਂ ਜਗ੍ਹਾ ਜਾ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਅਤੇ ਜੇ ਰਾਜੇਯ ਦੀ ਗੱਲ ਕੀਤੀ ਜਾਵੇ ਤਾਂ ਹੀ ਮੈਨੂੰ ਇੱਥੇ ਉੱਤਰ ਪ੍ਰਦੇਸ਼ ਵਿੱਚ ਬਹੁਤ ਜ਼ਿਆਦਾ ਧਾਰਮਿਕ ਜਗ੍ਹਾਵਾਂ ਹੈ ਜਿਹੜੇ ਮੇਰੀ ਮਨ ਨੂੰ ਮੇਰੇ ਦੁਰੋ ਨੂੰ ਬਹੁਤ ਜ਼ਿਆਦਾ ਭਾਉਂਦੀ ਹੈ ਅਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਜਾਣਾ ਅਤੇ ਮੈਂ ਜੇਕਰ ਕਿਤੇ ਘੁੰਮਣਾ ਚਾਹਾਂਗੀ ਤਾਂ ਮੈਂ ਉੱਤਰ ਪ੍ਰਦੇਸ਼ ਹੀ ਜਾਣਾ ਚਾਹਾਂਗੀ ਮੇਨਲੀ ਮਥੁਰਾ ਵਰਿੰਦਾਵਨ ਅਤੇ ਅਯੋਧਿਆ ਵਿੱਚ ਹਾਂਜੀ